ਹਾਂਜੀ ਮੇਰੀ ਰੋਜ਼ੀ ਰੋਟੀ ਬਿਜਲੀ 'ਤੇ ਹੀ ਨਿਰਭਰ ਹੈ ਕਿਉਂਕਿ ਮੈਂ ਮਾਲਸ਼ਾਂ ਦਾ ਕੰਮ ਕਰਦਾ ਹਾਂ ਹੱਡੀਆਂ ਦਾ ਜਿਵੇਂ ਕਿ ਲਾਈਟ ਚਲੀ ਜਾਂਦੀ ਹੈ ਪਹਿਲਾਂ ਮਸਾਜ ਕਰਦੇ ਸੀ ਹੱਥਾਂ ਨਾਲ ਹੁਣ ਮਸਾਜ ਹੱਥਾਂ ਨਾਲ ਪੋਸੀਬਲ ਨਹੀਂ ਹੁਣ ਮਸਾਜਰ ਆ ਗਏ ਮਾਰਕੀਟ ਦੇ ਵਿੱਚ ਐਕੂਪ੍ਰੈਸ਼ਰ ਮਸ਼ੀਨਾਂ ਆ ਗਈਆਂ ਕਿ ਉਹ ਬਿਜਲੀ 'ਤੇ ਹੀ ਚੱਲਦੇ ਆ ਬਿਜਲੀ ਤੋਂ ਬਗੈਰ ਨਹੀਂ ਚਲਦੇ ਹਾਂ ਇੱਥੇ ਲੋਕਾਂ ਕੋਲ ਇਨਵੈਟਰ ਵੀ ਹੈਗੇ ਭਾਰਤ ਇਨਵੈਟਰ ਮਸਾਜਰ ਦਾ ਮਸ਼ੀਨਾਂ ਦਾ ਲੋਡ ਨਹੀਂ ਚੁੱਕ ਸਕਦੇ ਜਿਹਦੇ ਕਰਕੇ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਸਾਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਕੋਈ ਪੇਸ਼ੈਂਟ ਮਰੀਜ਼ ਆਉਂਦਾ ਹੈ ਤਾਂ ਉਹਦੀ ਮਸਾਜ ਕਰਦੇ ਹਾਂ ਅਤੇ ਅਚਾਨਕ ਬਿਜਲੀ ਦਾ ਕੱਟ ਲੱਗ ਜਾਂਦਾ ਹੈ ਤਾਂ ਉਸ ਨੂੰ ਮੁਸ਼ਕਿਲ ਆਉਂਦੀ ਹੈ ਫੇਰ ਹੋਰ ਉੱਪਰ ਦੀ ਮਰੀਜ਼ ਆ ਜਾਂਦੇ ਆ ਜਦੋਂ ਬਿਜਲੀ ਨਹੀਂ ਹੁੰਦੀ ਅਤੇ ਮਸਾਜਰ ਨਹੀਂ ਚਲਦੇ ਜਿਹਦੇ ਕਰਕੇ ਬਿਜਲੀ ਦੇ ਕੱਟਾਂ ਕਾਰਨ ਮਸਾਜਰ ਨਹੀਂ ਚੱਲ ਪਾਉਂਦੇ ਅਤੇ ਮਰੀਜ਼ ਨੂੰ ਬੜੀ ਦਿੱਕਤ ਹੁੰਦੀ ਹੈ ਇਸ ਕਰਕੇ ਮੇਰੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ